ਮੇਰੇ ਰਹਿਣ ਵਾਲੇ ਸਥਾਨ 'ਤੇ ਬਹੁਤ ਜ਼ਿਆਦਾ ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਜਿਵੇਂ ਕਿ ਕਾਂ ਚਿੜੀ ਬਾਜ਼ ਅਤੇ ਹੋਰ ਪਰ ਮੇਰਾ ਪਸੰਦੀਦਾ ਪੰਛੀ ਬਾਜ਼ ਹੈ ਕਿਉਂਕਿ ਇਹ ਰਾਸ਼ਟਰੀਏ ਪੰਛੀ ਦੇ ਹੋਣ ਕਾਰਨ ਇੱਕ ਬਹਾਦਰ ਪੰਛੀ ਦਾ ਖਿਤਾਬ ਵੀ ਇਸ ਨੂੰ ਪਾਇਆ ਜਾਂਦਾ ਹੈ ਬਾਜ਼ ਇੱਕ ਅਜਿਹਾ ਪੰਛੀ ਹੈ ਜੋ ਕਿ ਸਾਰੇ ਪੰਛੀਆਂ ਤੋਂ ਅਲੱਗ ਹੈ ਅਤੇ ਇੱਕ ਬਹਾਦਰੀ ਦਾ ਚਿੰਨ੍ਹ ਹੈ ਇਸ ਕਰਕੇ ਬਾਜ਼ ਨੂੰ ਮੈਂ ਆਪਣਾ ਪਸੰਦੀਦਾ ਕਿਸਮ ਦਾ ਪੰਛੀ ਮੰਨਦੀ ਹਾਂ